ਆਮਦਨ ਟੈਕਸ ਦੀ ਰਿਟਰਨ ਦਾਖਲ ਕਰਨ ਦੀ ਲਾਸਟ ਡੇਟ ਆਉਣ ਵਾਲੀ ਹੈ ਪ੍ਰੰਤੂ ਆਮਦਨ ਟੈਕਸ ਦੇ ਬਹੁਤ ਸਾਰੇ ਜਿਹੜੇ ਫਾਰਮ ਹੈਗੇ ਹੈ ਤਾਂ ਕਿਹੜਾ ਫਾਰਮ ਜਿਹੜਾ ਮੇਰੇ ਲਈ ਲਾਗੂ ਹੋਵੇਗਾ ਉਹਦਾ ਮੈਨੂੰ ਪਤਾ ਨਹੀਂ ਹੈਗਾ ਇਸ ਕਰਕੇ ਜਾਂ ਤਾਂ ਮੈਂ ਕਿਸੇ ਸੀਏ ਦੀ ਹੈਲਪ ਲਵਾਂਗਾ ਉਸ ਨੂੰ ਪੁੱਛਾਂਗਾ ਜਾਂ ਮੈਂ ਫਿਰ ਕਿਸੇ ਇੰਟਰਨੈੱਟ ਵਗੈਰਾ ਤੋਂ ਸਰਚ ਕਰਦਾ ਹੈ ਕੀ ਜਿਸ ਤਰ੍ਹਾਂ ਦੀ ਮੇਰੀ ਆਮਦਨ ਹੈ ਓਸ ਨੂੰ ਕਿਹੜੇ ਇਨਕਮ ਟੈਕਸ ਰਿਟਰਨ ਦੇ ਫਾਰਮ ਦੇ ਦੁਆਰਾ ਭਰਿਆ ਜਾਏਗਾ ਕਿਉਂਕੀ ਜੇ ਇਹ ਗਲਤ ਹੋ ਗਿਆ ਤਾਂ ਵੀ ਠੀਕ ਨਹੀਂ ਹੈ ਉਸ ਦਾ ਫਿਰ ਇਨਕਮ ਟੈਕਸ ਵਿਭਾਗ ਜਿਹੜਾ ਮੇਰੇ ਤੋਂ ਕੋਈ ਜੁਰਮਾਨਾ ਵਸੂਲ ਸਕਦਾ ਹੈ ਲੇਕਿਨ ਮੈਂ ਦੋ ਤਿੰਨ ਦੋਸਤਾਂ ਨਾਲ ਕੰਸਲਟ ਕਰਿਆ ਸੀਗਾ ਉਹ ਦੋਨਾਂ ਤਿੰਨਾਂ ਦੇ ਵਿਚਾਰ ਅਲੱਗ ਅਲੱਗ ਸੀਗੇ ਉਹ ਮੈਨੂੰ ਲੱਗਿਆ ਵੀ ਸ਼ਾਇਦ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ਜਾਂ ਤਾਂ ਮੈਂ ਗੂਗਲ ਵਗੈਰਾ ਤੋਂ ਉਹਨੂੰ ਖੋਜ ਕਰਾਂ ਲੱਭਾਂ ਵੀ ਕਿਹੜਾ ਹੈ ਜਾਂ ਫਿਰ ਮੈਨੂੰ ਸੀਏ ਕੋਲ ਜਾਣਾ ਪਏਗਾ ਸੀਏ ਫਿਰ ਆਪਣਾ ਜਿਹੜੇ ਹੈ ਉਹ ਫੀਸ ਜਾਂ ਚਾਰਜਸ ਜਿਹੜੇ ਹੈਗੇ ਹੈ ਉਹ ਲਏਗਾ ਅਤੇ ਚਲੋ ਦੇਖਦੇ ਹਾਂ ਹੁਣ ਲਾਸਟ ਡੇਟ ਤੱਕ ਰਿਟਰਨ ਤਾਂ ਭਰਨੀ ਪਏਗੀ ਲੇਕਿਨ ਹੈ ਥੋੜ੍ਹਾ ਮੁਸ਼ਕਿਲ ਕੰਮ ਕਿਉਂਕੀ ਇਸ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਹੈ ਧੰਨਵਾਦ